ਟੈਕਨੋਲਜੀ ਬਹੁਤ ਵੱਧ ਗਈ ਹੈ ਜਿਹਦਾ ਹਿੱਸਾ ਵਾਈਫਾਈ ਅਤੇ ਮੋਬਾਈਲ ਡਾਟਾ ਦੋਵੇਂ ਹੀ ਹੈ ਅਤੇ ਮੈਂ ਦੋਨਾਂ ਦੀ ਹੀ ਵਰਤੋਂ ਕਰਦਾ ਹਾਂ ਜਦੋਂ ਮੈਂ ਯੂਨੀਵਰਸਿਟੀ ਹੁੰਦਾ ਹਾਂ ਉਦੋਂ ਮੋਬਾਇਲ ਡਾਟਾ ਚਲਾਉਂਦਾ ਹਾਂ ਅਤੇ ਜਦੋਂ ਮੈਂ ਘਰ ਚਲ ਜਾਂਦਾ ਹਾਂ ਅਤੇ ਉਦੋਂ ਮੈਂ ਵਾਈਫਾਈ ਯੂਸ ਕਰਦਾ ਹਾਂ ਅਤੇ ਮੈਂ ਪੜ੍ਹਾਈ ਵਾਸਤੇ ਜਾਂ ਗੇਮਾਂ ਖੇਡਣ ਵਾਸਤੇ ਜਾਂ ਕੁਛ ਦੇਖਣ ਵਾਸਤੇ ਯੂਟੀਊਬ ਤੋਂ ਜਾਂ ਇੰਟਰਨੈੱਟ ਤੋਂ ਤਾਂ ਮੈਂ ਵਾਈਫਾਈ ਯੂਜ਼ ਕਰਦਾ ਹਾਂ ਜਿਹਦੇ ਕਰਕੇ ਕਿ ਮੈਨੂੰ ਬਹੁਤ ਜ਼ਿਆਦਾ ਮਦਦ ਹੁੰਦੀ ਹੈ ਕੋਈ ਟੋਪਿਕ ਸਮਝਣ ਦੇ ਵਿੱਚ ਆਪਣੀ ਆਪਣਾ ਮਨੋਰੰਜਨ ਕਰਨ ਦੇ ਵਿੱਚ ਅਤੇ ਫਿਰ ਉਹਦੇ ਬਾਅਦ ਮੇਰੀ ਇੱਕ ਦਿਨ ਦੀ ਇੱਕ ਦਿਨ ਦੀ ਵਰਤੋਂ ਡਾਟਾ ਦੀ ਹੈਗੀ ਆ ਪੰਦਰਾਂ ਜੀਬੀ ਅਤੇ ਫਿਰ ਉਹਦੇ ਬਾਅਦ ਮੈਂ ਨੈੱਟਵਰਕ ਸਮੱਸਿਆ ਨੈੱਟਵਰਕ ਸਮੱਸਿਆ ਦੀ ਗੱਲ ਕਰਾਂ ਤਾਂ ਜਿੱਦਾਂ ਹੁਣ ਕਿਤੇ ਕਿਤੇ ਨੈੱਟਵਰਕ ਨਹੀਂ ਆਉਂਦੇ ਤਾਂ ਅਸੀਂ ਸੋਚੀਦਾ ਕਿ ਅਸੀਂ ਆਪਣੇ ਘਰਦਿਆਂ ਨਾਲ ਕਿੱਦਾਂ ਗੱਲ ਕਰਨੀ ਹੈ ਜਾਂ ਕਿਸੇ ਨੂੰ ਕੋਈ ਗੱਲ ਕਿੱਦਾਂ ਪਹੁੰਚਾਉਣੀ ਹੈ ਉਹਨੂੰ ਇੰਨਫੋਰਮ ਕਿੱਦਾਂ ਕਰਨਾ ਕਿ ਮੈਂ ਮੈਂ ਇੱਥੋਂ ਲੇਟ ਇੱਦਾਂ ਹੋ ਗਿਆ ਜਾਂ ਉਹਦਾ ਕੀ ਰੀਜ਼ਨ ਸੀਗਾ ਕਿ ਮੈਂ ਨਹੀਂ ਆ ਸਕਿਆ ਤੇਰੇ ਕੋਲ ਫਿਰ ਉਹਦੇ ਬਾਅਦ ਆਪਣਾ ਕਿ ਹੁਣ ਜਿੱਦਾਂ ਮੈਂ ਗੇਮ ਖੇਡਦੇ ਖੇਡਦੇ ਨੈੱਟਵਰਕ ਹੁਣ ਅੱਜ ਕੱਲ੍ਹ ਔਨ ਔਨਲਾਈਨ ਗੇਮਸ ਦਾ ਜਮਾਨਾ ਹੈ ਅਤੇ ਮੈਂ ਔਨਲਾਈਨ ਗੇਮ ਖੇਡਦੇ ਖੇਡਦੇ ਨੈੱਟਵਰਕ ਇਸ਼ੂ ਆ ਜਾਂਦਾ ਹੈ ਜਿਹਦੇ ਕਰਕੇ ਕੀ ਗੇਮ ਬੰਦ ਹੋ ਜਾਂਦੀ ਇੱਕੋ ਦਮ ਹੀ ਬੰਦ ਹੋ ਜਾਂਦੀ ਹੈ ਅਤੇ ਫਿਰ ਉਹਦੇ ਬਾਅਦ ਮੈਂ ਉਹ ਮੈਚ ਹਾਰ ਜਾਂਦਾ ਹਾਂ ਫਿਰ ਉਹਦੇ ਬਾਅਦ ਕਦੇ ਕਦਾਈ ਇੱਦਾਂ ਹੁੰਦਾ ਹੈ ਕਿ ਨੈੱਟ ਚੱਲਣਾ ਹੀ ਬੰਦ ਹੋ ਜਾਂਦਾ ਕਿ ਅਸੀਂ ਜੇ ਕਿਤੇ ਕਿਸੇ ਨੂੰ ਫ਼ੋਨ ਵੀਡੀਓ ਕੋਨਫਰੈਸਿੰਗ 'ਤੇ ਹਾਂ ਅਤੇ ਇੱਕੋ ਦਮ ਨੈੱਟ ਬੰਦ ਹੋ ਗਿਆ ਅਤੇ ਉਹਦਾ ਅਤੇ ਸਾਡਾ ਲਿੰਕ ਦੋਨਾਂ ਦਾ ਟੁੱਟ ਜਾਂਦਾ ਹੈ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉਹਦੇ ਨਾਲ ਕੀ ਗੱਲ ਕਰ ਰਹੇ ਸੀਗੇ ਜਾਂ ਕਿਹੜੇ ਟੋਪਿਕ 'ਤੇ ਅਸੀਂ ਗੱਲ ਕਰ ਰਹੇ ਸੀਗੇ ਅਤੇ ਫਿਰ ਉਹਦੇ ਬਾਅਦ ਆਪਣਾ ਮੋਬਾਇਲ ਨੈੱਟ ਸਮੱਸਿਆਵਾਂ ਹੋਰ ਹੋਰ ਵੀ ਬੜੀਆਂ ਸਮੱਸਿਆਵਾਂ ਹਨ ਜਿਵੇਂ ਕਿ ਯੂਜਏਜ ਕਦੇ ਕਦਾਰ ਇੱਦਾਂ ਹੁੰਦਾ ਹੈ ਕਿ ਸਾਨੂੰ ਨੈੱਟ ਸਾਡਾ ਨੈੱਟ ਖਤਮ ਹੋ ਜਾਂਦਾ ਤਾਂ ਫਿਰ ਉਹਦੇ ਬਾਅਦ ਜਿਵੇਂ ਕਿ ਫ਼ੋਨ ਜਾਂਦੇ ਹਨ ਕਿ ਰੀਚਾਰਜ ਕਰਵਾ ਲਓ ਜਾਂ ਇੱਦਾਂ ਤਾਂ ਫਿਰ ਉਹਦੇ ਬਾਅਦ ਸਾਨੂੰ ਜਿਹੜਾ ਕਦੇ ਕਦਾਰ ਇੱਦਾਂ ਹੋਣਾ ਚਾਹੀਦਾ ਕਿ ਸਾਨੂੰ ਥੋੜ੍ਹਾ ਜਿਹਾ ਐਕਸਟਰਾ ਡਾਟਾ ਮਿਲਣਾ ਚਾਹੀਦਾ ਜਿਵੇਂ ਕਿ ਸਾਡਾ ਕੋਈ ਡਾਟਾ ਬਚ ਗਿਆ ਜਿਵੇਂ ਦੋ ਜੀਬੀ ਮੇਰਾ ਮੈਂ ਅੱਜ ਕੁਛ ਫੋਨ ਨਹੀਂ ਚਲਾਇਆ ਮੈਂ ਯੂਜ਼ ਨਹੀਂ ਕੀਤਾ ਤਾਂ ਮੇਰਾ ਦੋ ਜੀਬੀ ਬਚ ਗਿਆ ਤਾਂ ਮੈਨੂੰ ਅੱਗੇ ਐਡਅੋਨ ਹੋ ਜਾਣਾ ਚਾਹੀਦਾ ਮੇਰੇ ਨੈੱਟਵਰਕ ਕਿਉਂਕਿ ਹਰ ਇੱਕ ਚੀਜ਼ ਪੈਸੇ ਦੀ ਆਉਂਦੀ ਹੈ ਅਤੇ ਅਸੀਂ ਉਹ ਹੀ ਚੀਜ਼ ਪੈਸੇ ਦੀ ਲਈਦੀ ਹੈ ਅਤੇ ਸਾਨੂੰ ਇੱਦਾਂ ਹੋਣਾ ਚਾਹੀਦਾ ਕਿ ਜਿਹੜੇ ਆ ਡਾਟਾ ਸਾਡਾ ਬਚ ਗਿਆ ਉਹ ਅਗਲੇ ਜਿਹੜਾ ਅਗਲੇ ਦਿਨ ਦਾ ਡਾਟਾ ਮਿਲੂਗਾ ਉਹਦੇ ਵਿੱਚ ਐਡਅੋਨ ਹੋ ਜਾਣਾ ਚਾਹੀਦਾ ਹੈ